ਮੈਂ ਜ਼ਿਆਦਾਤਰ ਖਾਣਾ ਬਣਾਉਣ ਵੇਲੇ ਨੋਨ ਸਟਿੱਕ ਬਰਤਨਾਂ ਦੀ ਵਰਤੋ ਵੱਧ ਕਰਦੀ ਹਾਂ ਕਿਉਂਕਿ ਇਹਨਾਂ ਵਿੱਚ ਤੇਲ ਦੀ ਮਾਤਰਾ ਬਹੁਤ ਘੱਟ ਪੈਂਦੀ ਹੈ ਅਤੇ ਇਹਨਾਂ ਬਰਤਨਾਂ ਦੇ ਵਿੱਚ ਖਾਣਾ ਥੱਲੇ ਵੀ ਨਹੀਂ ਲੱਗਦਾ ਅਤੇ ਜਿਹੜੀ ਕਟਲਰੀ ਦੀ ਵਰਤੋਂ ਨੋਨ ਸਟਿੱਕ ਬਰਤਨਾਂ ਦੇ ਵਿੱਚ ਮੈਂ ਜ਼ਿਆਦਾਤਰ ਵੂਡਨ ਦੀ ਵਰਤੋਂ ਕਰਦੀ ਹਾਂ ਅਤੇ ਉਸ ਤੋਂ ਇਲਾਵਾ ਬਾਕੀ ਬਰਤਨਾਂ ਦੇ ਲਈ ਜ਼ਿਆਦਾਤਰ ਸਟੇਨਲੈਸ ਸਟੀਲ ਦੇ ਭਾਂਡਿਆਂ ਦੀ ਹੀ ਵਰਤੋਂ ਕਰਦੀ ਹਾਂ